ਕੀ ਤੁਸੀਂ ਕਦੇ ਕਿਸੇ ਖਾਸ ਮੌਕੇ 'ਤੇ ਜਾਂ ਤਿਉਹਾਰ ਲਈ ਬੁਣਾਈ ਕੀਤੀ ਹੈ ਹਾਂ ਹਾਂਜੀ ਮੈਨੂੰ ਆਪਣੀਆਂ ਮਤਲਬ ਹੱਥ ਨਾਲ ਬਣਾਈਆਂ ਕੋਟੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਹਨ ਮੈਂ ਜ਼ਿਆਦਾਤਰ ਆਪਣੇ ਹੱਥ ਨਾਲ ਬਣਾਈਆਂ ਕੋਟੀਆਂ ਹੀ ਪਾਉਂਦੀ ਹਾਂ ਮੈਨੂੰ ਨਵੇਂ ਤੋਂ ਨਵੇਂ ਡਿਜ਼ਾਇਨ ਸਿੱਖਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਆਪਣੇ ਹੱਥ ਨਾਲ ਬਣਾ ਕੇ ਕੋਟੀਆਂ ਕਾਫੀ ਮਤਲਬ ਜਿੱਦਾਂ ਹੁਣ ਕੋਈ ਫੰਕਸ਼ਨ ਵਗੈਰਾ ਹੁੰਦਾ ਤਾਂ ਮਤਲਬ ਆਪਣੇ ਹੱਥੀਂ ਬਣਾ ਕੇ ਦੇਣਾ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਉਹ ਬਹੁਤ ਜ਼ਿਆਦਾ ਮਤਲਬ ਆਪਾਂ ਨੂੰ ਵਾਰਮ ਰੱਖਦੀਆਂ ਅਤੇ ਹੋਰ ਮਤਲਬ ਮੈਂ ਜ਼ਿਆਦਾ ਮਤਲਬ ਕੋਟੀਆਂ ਤੋਂ ਇਲਾਵਾ ਮਤਲਬ ਜਿੱਦਾਂ ਮਫਰਲ ਹੋ ਗਏ ਅਤੇ ਇਹ ਸਕਾਫ ਹੋ ਗਏ ਸਟਾਲ ਹੋ ਗਏ ਅਤੇ ਬੈਡਸ਼ੀਟ ਹੋ ਗਈ ਪਿੱਲੋ ਕਵਰ ਹੋ ਗਏ ਮਤਲਬ ਸਾਰਾ ਕੁਝ ਮਤਲਬ ਬਹੁਤ ਵਧੀਆ ਢੰਗ ਨਾਲ ਮੈਂ ਬਣਾ ਲੈਂਦੀ ਹਾਂ ਅਤੇ ਮੈਨੂੰ ਇਹ ਬਣਾਈਆਂ ਮਤਲਬ ਬਹੁਤ ਹੀ ਵਧੀਆ ਲੱਗਦੀਆਂ ਹਨ